ਬਹੁਤ ਸਾਰੇ ਵਿਸ਼ੇ ਹਨ ਜਿਹਨਾਂ ਨੂੰ ਮੈਂ ਪੜ੍ਹ ਰਹੀ ਹਾਂ ਜਿਵੇਂ ਕਿ ਕੰਪਿਊਟਰ ਸਾਇੰਸ ਰਿਲੇਟਿਡ ਬਹੁਤ ਸਾਰੇ ਵਿਸ਼ੇ ਹਨ ਪਰ ਮੈਂ ਹਜੇ ਤੱਕ ਰਿਸਰਚ ਹੀ ਕਰ ਰਹੀ ਹਾਂ ਕਿ ਕਿਹੜੇ ਟੋਪਿਕ ਦੇ ਉੱਤੇ ਲਿਖਿਆ ਜਾਵੇ ਤਾਂ ਕਿ ਉਹ ਟੋਪਿਕ ਜੋ ਮੈਂ ਲਿਖਾਂ ਉਸ ਨੂੰ ਕੋਈ ਪੜ੍ਹ ਕੇ ਬਹੁਤ ਅੱਗੋਂ ਕੰਮ ਲੈ ਸਕੇ ਇਸ ਕਰਕੇ ਮੈਂ ਹਜੇ ਤੱਕ ਇੰਨਾ ਜ਼ਿਆਦਾ ਤਾਂ ਨਹੀਂ ਸੋਚਿਆ ਪਰ ਕੁਛ ਗੱਲਾਂ ਇਹ ਹਨ ਕਿ ਕੁੜੀਆਂ ਅੱਜ ਕੱਲ੍ਹ ਅਲਰਟ ਨਹੀਂ ਹਨ ਸਭ ਚੀਜ਼ਾਂ ਤੋਂ ਤਾਂ ਸਾਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕੁੜੀਆਂ ਦੇ ਬਾਰੇ ਸਾਰਾ ਕੁਛ ਲਿਖੇ ਲਿਖੀਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਪਹਿਲਾਂ ਹੀ ਸਭ ਤੋਂ ਅ ਧਿਆਨ ਵਿੱਚ ਹੋਣ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਪਹਿਲਾਂ ਹੀ ਦੱਸਿਆ ਜਾਵੇ ਸਭ ਚੀਜ਼ਾਂ ਬਾਰੇ ਤਾਂ ਕਿ ਜੋ ਵੀ ਅਣਹੋਣੀਆਂ ਹੁੰਦੀਆਂ ਹਨ ਉਹ ਨਾ ਹੋਣ ਇਸ ਤਰ੍ਹਾਂ ਅਸੀਂ ਉਹ ਸਭ ਚੀਜ਼ਾਂ ਬਾਰੇ ਲਿਖੀਏ ਨਾਲੇ ਅਸੀਂ ਪੜ੍ਹਦੇ ਹੋਏ ਸਮਾਜ ਬਾਰੇ ਲਿਖੀਏ ਤਾਂ ਕਿ ਅਸੀਂ ਪੜ੍ਹਾਈ ਦੀ ਮਹੱਤਤਾ ਨੂੰ ਜ਼ਿਆਦਾ ਕਰ ਪਾਈਏ ਇਸ ਨਾਲ ਕੀ ਹੈ ਕਿ ਜੋ ਸਾਡਾ ਸਮਾਜ ਹੈ ਉਹ ਪੜ੍ਹਿਆ ਲਿਖਿਆ ਜ਼ਿਆਦਾ ਹੋਵੇਗਾ ਅਤੇ ਸਾਨੂੰ ਉਸ ਦੇ ਵਿੱਚ ਵਿਚਰਨ ਦਾ ਮੌਕਾ ਮਿਲੂਗਾ ਅਤੇ ਸਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਅਸੀਂ ਪੜ੍ਹਾਈ ਦੀ ਮਹੱਤਤਾ ਬਾਰੇ ਟੈਕਨੋਲੋਜੀ ਬਾਰੇ ਲਿਖਣਾ ਚਾਹੀਏ ਧੰਨਵਾਦ